ਮੇਰੇ ਸ਼ਹਿਰ ਰੋਪੜ ਵਿੱਚ ਦਾ ਰੋਪੜ ਦਾ ਇੱਕ ਮਸ਼ਹੂਰ ਕਿੱਤਾ ਸੀ ਜਿ ਇੱਥੇ ਦੇ ਤਾਲੇ ਜਿਹੜੇ ਲੌਕ ਜਿਨ੍ਹਾਂ ਨੂੰ ਇੰਗਲਿਸ਼ 'ਚ ਕਿਹਾ ਜਾਂਦਾ ਹੈ ਉਹ ਬੜੇ ਮਸ਼ਹੂਰ ਸੀਗੇ ਅਤੇ ਪੁਰਾਣੇ ਸਮੇਂ ਵਿੱਚ ਬਹੁਤ ਲੋਕ ਹੱਥੀਂ ਉਨ੍ਹਾਂ ਤਾਲਿਆਂ ਨੂੰ ਬਣਦਾ ਦੇਖਣ ਆਉਂਦੇ ਸਨ ਇਹ ਜਿਹੜੇ ਤਾਲੇ ਸੀਗੇ ਕੋਈ ਆਮ ਬੰਦਾ ਇਨ੍ਹਾਂ ਨੂੰ ਤੋੜ ਨਹੀਂ ਤਾ ਸਕਦਾ ਨਾ ਹੀ ਖੋਲ੍ਹ ਸਕਦਾ ਸੀਗਾ ਅਤੇ ਜ ਹੁਣ ਇਹ ਜਿਹੜੀ ਪ੍ਰਚਲਿਤ ਸੀਗੀ ਜਿਹੜੀ ਇਸ ਲੌਕਾਂ ਦੀ ਤਾਲਿਆਂ ਦੀ ਉਹ ਬੜੀ ਘੱਟ ਗਈ ਕਿਉਂਕਿ ਜਿਹੜੇ ਲੋਕ ਆਉਂਦੇ ਸੀਗੇ ਉਹਨਾਂ ਨੇ ਇਹ ਕਿੱਤਾ ਸਿੱਖ ਲਿਆ ਅਤੇ ਵੱਖ ਵੱਖ ਹੋਰ ਸ਼ਹਿਰਾਂ ਦੇ ਵਿੱਚ ਵਧ ਗਿਆ